ਬਾਈਕ ਚਲਾਨ ਦੇ ਸਰੀਰਿਕ ਅਤੇ ਮਾਨਸਿਕ ਲਾਭ ਇਹ ਹਨ ਸਭ ਤੋਂ ਪਹਿਲਾਂ ਕੀ ਹੈ ਜਦੋਂ ਆਪਾਂ ਬਾਈਕ ਚਲਾਨੇ ਹਾਂ ਅਤੇ ਤੁਹਾਡੀ ਜਿਹੜੀ ਸਾਡਾ ਸਰੀਰ ਹੈ ਉਹ ਉਸ ਸਮੇਂ ਬਹੁਤ ਜ਼ਿਆਦਾ ਕੀ ਕਹਿੰਦੇ ਨੇ ਓ ਐਕਸ਼ਨ ਦੇ ਵਿੱਚ ਹੁੰਦਾ ਹੈ ਕਿ ਜਦੋਂ ਆਪਾਂ ਬਾਇਕ ਇੱਧਰ ਉੱਧਰ ਮੋੜਦੇ ਆ ਸਭ ਕੁਝ ਕਰਦੇ ਸਾਡੇ ਜਿਹੜੇ ਮੈਂਟਲੀ ਆ ਜਦ ਆਪਾਂ ਬਾਈਕ ਚਲਾਉਂਦੇ ਆ ਆਪਾਂ ਆਸੇ ਪਾਸੇ ਦੇ ਗੱਡੀਆਂ ਨੂੰ ਦੇਖਦੇ ਹਾਂ ਕਿ ਜਿਹੜਾ ਕਿ ਆਪਾਂ ਇੱਥੇ ਦੇਖਦੇ ਹਾਂ ਕਿ ਇਥੇ ਘੱਟ ਤੋਂ ਘੱਟ ਲੋਕ ਇੰਡੀਕੇਟਰ ਦਿੰਦੇ ਨੇ ਮੁੜਨ ਤੋਂ ਵਕਤ ਅਸੀਂ ਉਹਦੇ ਨਾਲ ਕੀ ਹੈ ਸਾਡਾ ਜਿਹੜਾ ਮਾਨਸਿਕ ਹੈ ਦੂਜੇ ਬੰਦੇ 'ਤੇ ਜਿਹੜਾ ਮੂਵ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਉਹਨੇ ਲੈਫਟ ਮੁੜਨਾ ਕਿ ਰੈ ਖੱਬੇ ਜਾਣਾ ਕਿ ਸੱਜੇ ਜਾਣਾ ਸੋ ਉਹਦੇ ਕਰਕੇ ਕਿ ਸਾਡੀ ਹੈ ਬਾਈ ਚਲਾਨ ਦੇ ਵਕਤ ਮਾਨਸਿਕ ਜਿਹੜੀ ਐਕਸਰਸਾਈਜ ਮਾਨਸਿਕ ਕਸਰਤ ਹੁੰਦੀ ਆ ਉਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਬਾਈਕ ਹੈਗੀ ਹੈ ਉਹਨੂੰ ਆਪਾਂ ਕੰਟਰੋਲ ਕਰਨ ਨਾਲ ਸਰੀਰ ਸਾਡਾ ਪ੍ਰੋਪਰਲੀ ਉਹਦੇ ਵਿੱਚ ਰੁੱਝਿਆ ਹੁੰਦਾ ਹੈ ਜਿਹਦੇ ਕਰਕੇ ਆਪਣਾ ਬਾਈਕ ਚਲਾਉਂਦੇ ਹੋਏ ਸਾਡਾ ਸਾਰਾ ਦਾ ਸਾਰਾ ਧਿਆਨ ਬਾਈਕ 'ਤੇ ਹੁੰਦਾ ਹੈ ਕਿ ਉਹਨੂੰ ਆਪਾਂ ਤੇਜ ਚਲਾਉਣਾ ਸਲੋਅ ਕਰਨਾ ਬ੍ਰੇਕ ਮਾਰਨੀ ਗੇਅਰ ਪਾਉਣਾ ਸੋ ਜਿੱਦਾਂ ਕਿ ਆਪਾਂ ਦੇਖਦੇ ਹਾਂ ਜਿੱਦਾਂ ਕਿ ਆਪਾਂ ਸਕੂਟਰ ਚਲਾਉਂਦੇ ਹਾਂ ਉਹਦੇ ਵਿੱਚ ਸਿਰਫ ਰੇਸ ਹੁੰਦੀ ਇਹਦੇ ਵਿੱਚ ਕਿ ਆਪਾਂ ਗੇਰ ਵੀ ਪਾਨੇ ਹਾਂ ਰੇਸ ਵੀ ਦੇਣੀ ਆ ਬਰੇਕ ਵੀ ਮਾਰਨੀ ਅਤੇ ਇਹਦੇ ਵਿੱਚ ਕੋਬੀਨੇਸ਼ਨ ਆਫ ਮਤਲਬ ਸਾਰਿਆਂ ਦਾ ਇੱਕ ਮਿਸ਼ਰਨ ਦੇ ਨਾਲ ਫਿਰ ਸਾਡੀ ਬਾਈਕ ਚੱਲਦੀ ਹੈ ਤਾਂ ਕਰਕੇ ਸਾ ਸਾਡਾ ਮਾਨਸਿਕ ਅਤੇ ਸਰੀਰਕ ਹਮੇਸ਼ਾ ਵਿਅਸਤ ਰਹਿੰਦਾ ਜਿਹਦੇ ਕਰਕੇ ਸਾਡੀ ਇਹਦੀ ਐਕਸਰਸਾਈਜ਼ ਹੁੰਦੀ ਹੈ ਜਿਹਦੇ ਕਰਕੇ ਮੇਰੇ ਨਾਲ ਵੀ ਇੱਦਾਂ ਹੁੰਦਾ ਕਈ ਵਾਰੀ ਮੈਂ ਬਹੁਤ ਜ਼ਿਆਦਾ ਥੱਕਿਆ ਹੁੰਦਾ ਜਦ ਮੈਂ ਕਿਸੇ ਟੈਨਸ਼ਨ ਦੇ ਵਿੱਚ ਹੁੰਦਾ ਮੈਂ ਕੀ ਕਰਦਾ ਮੈਂ ਤਾਂ ਜਾਂ ਆਪਣੀ ਗੱਡੀ ਜਾ ਆਪਣੀ ਮੈਂ ਬਾਈਕ ਚੱਕਦਾ ਵਾਂ ਅਤੇ ਮੈਂ ਇੱਕ ਵ ਵੱਡਾ ਜਿਹਾ ਗੇੜਾ ਕੱਢ ਕੇ ਆਉਂਦਾ ਉਹਦੇ ਨਾਲ ਕੀ ਆ ਮੇਰਾ ਮਾਇੰਡ ਮੇਰਾ ਸਰੀਰ ਇੱਕਦਮ ਫਰੈਸ਼ ਹੋ ਜਾਂਦਾ ਅਤੇ ਮੈਨੂੰ ਜਦੋਂ ਗੁੱਸਾ ਵਗੈਰਾ ਗਿਲਾ ਆਇਆ ਹੁੰਦਾ ਉਹ ਮੈਂ ਬਾਈਕ ਚਲਾ ਕੇ ਮੇਰੇ ਦੂਰ ਹੋ ਜਾਂਦਾ ਜਿਹਨੂੰ ਕਿ ਆਪਾਂ ਭਾ ਅੰਗਰੇਜੀ ਭਾਸ਼ਾ 'ਚ ਕਹਿੰਦੇ ਕਿ ਜਦ ਆਪਾਂ ਬਾਈਕ ਚਲਾਉਂਦੇ ਅਤੇ ਅਗਰੈਸ਼ਨ ਹੁੰਦਾ ਉਹ ਜਦ ਅਗਰੈਸ਼ਨ ਨਿਕਲ ਜਾਂਦਾ ਅਤੇ ਸਾਡੇ ਜਿਹੜੇ ਗੁਡ ਹੋਰ ਗੁੱਡ ਅੰਦਰ ਦੇ ਜਿਹੜੀ ਤਵੀਆਂ ਹੁੰਦੀਆਂ ਉਹ ਅੱਛੀ ਹੋਣ ਲੱਗ ਜਾਂਦੀ ਹੈ